ਜੀ ਹਾਂ ਸਾਡੀ ਰੋਜ਼ੀ ਰੋਟੀ ਬਿਜਲੀ 'ਤੇ ਨਿਰਭਰ ਕਰਦੀ ਹੈ ਅੱਜ ਕੱਲ੍ਹ ਦੇ ਸਮੇਂ ਵਿੱਚ ਹਰ ਚੀਜ਼ ਬਿਜਲੀ 'ਤੇ ਚਲਦੀ ਹੈ ਜਿਵੇਂ ਕਿ ਫਰਿੱਜ ਵਗੈਰਾ ਸਲੰਡਰ ਗੈਸ ਸਲੰਡਰ ਹੀਟਰ ਗੀਜਰ ਵਗੈਰਾ ਇਹ ਸਭ ਚੀਜ਼ਾਂ ਬਿਜਲੀ 'ਤੇ ਨਿਰਭਰ ਹਨ ਤਾਂ ਇਸ ਕਰਕੇ ਸਾਡੀ ਰੋਜ਼ੀ ਰੋਟੀ ਬਿਜਲੀ 'ਤੇ ਨਿਰਭਰ ਕਰਦੀ ਹੈ ਬਿਜਲੀ ਦੇ ਕੱਟ ਦੌਰਾਨ ਗਰਮੀਆਂ ਵਿੱਚ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਜਿਵੇਂ ਕਿ ਲੈਟ ਚਲੇ ਜਾਣ ਤੋਂ ਬਾਅਦ ਪੱਖੇ ਕੂਲਰ ਵਗੈਰਾ ਬੰਦ ਹੋ ਜਾਂਦੇ ਹਨ ਫਰਿੱਜ ਬੰਦ ਹੋ ਜਾਂਦੀ ਹੈ ਜਿਸ ਕਾਰਨ ਸਾਡੀਆਂ ਸਬਜ਼ੀਆਂ ਆਟਾ ਵਗੈਰਾ ਖ਼ਰਾਬ ਹੋ ਜਾਂਦਾ ਹੈ ਬਹੁਤ ਦਿਕੱਤ ਹੁੰਦੀ ਹੈਗੀ ਅਤੇ ਰੋਟੀ ਵਗੈਰਾ ਰਾਤ ਨੂੰ ਲਾਈਟ ਜਾਣ ਤੋਂ ਬਾਅਦ ਦਿਕੱਤ ਹੋ ਜਾਂਦੀ ਆ ਬਣਾਉਣ ਦੀ ਵੀ ਲਾਈਟ ਨਹੀਂ ਹੁੰਦੀ ਹਨੇਰੇ 'ਚ ਰੋਟੀ ਪਾਣੀ ਬਣਦਾ ਨਹੀਂ ਫਿਰ ਬੱਚੇ ਛੋਟੇ ਹੋਣ ਕਰਕੇ ਉਹਨਾਂ ਦੀ ਨਿਗਾਹ ਰੱਖਣੀ ਪੈਂਦੀ ਹੈ ਕਿ ਬੱਚਾ ਸਾਡਾ ਇਧਰ ਉਧਰ ਨਾ ਹੋ ਜਾਵੇ ਮੇਰੇ ਬੱਚਾ ਤਾਂ ਹੁੰਦਾ ਬਿਜਲੀ ਕੱਟ ਜਾਣ ਗਰਮੀ 'ਚ ਮੱਛਰ ਵਗੈਰਾ ਬਹੁਤ ਜ਼ਿਆਦਾ ਹੁੰਦੇ ਹੈਗਾ ਜਿਸ ਕਾਰਨ ਬਹੁਤ ਹੀ ਦਿੱਕਤ ਹੁੰਦਾ ਹੈਗੀ ਇਹ ਬਿਜਲੀ ਦੇ ਕੱਟ ਵਿੱਚ ਰੋਸ਼ਨੀ ਲਈ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਕਿ ਲਾਲਟੈਨ ਮੋਮਬੱਤੀ ਦੀਵਾ ਵਗੈਰਾ ਵਰਤਿਆ ਜਾਂਦਾ ਅਤੇ ਅੱਜ ਕੱਲ੍ਹ ਦੇ ਸਮੇਂ ਵਿੱਚ ਕਈ ਸਾਰੇ ਲੋਕਾਂ ਕੋਲ ਇੰਨਵੈਟਰ ਹਨ ਜਿਨ੍ਹਾਂ ਕੋਲ ਇੰਨਵੈਟਰ ਨਹੀਂ ਆ ਉਹਨਾਂ ਨੇ ਸੋਲਰ ਸਿਸਟਮ ਲਗਾ ਰੱਖਿਆ ਜਿਨ ਸੋਲਰ ਸਿਸਟਮ ਵੈਸੇ ਤਾਂ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਬਟ ਆਪਣੀ ਵਾਤਾਵਰਣ ਨੂੰ ਬਹੁਤ ਜ਼ਿਆਦਾ ਦਿੱਕਤ ਨਹੀਂ ਹੁੰਦੀ ਹੈਗੀ ਸਿਸਟਮ ਨਾਲ ਸੋਲਰ ਸਿਸਟਮ ਆਪਣੇ ਵਾਤਾਵਰਨ ਨੂੰ ਵਧੀਆ ਰੱਖਦਾ ਵਾ ਉਹਦੇ ਕਰਕੇ ਧੁੱਪ ਜ਼ਿਆਦਾ ਹੁੰਦੀ ਹੈ ਜਾਂ ਬਿਜਲੀ ਜ਼ਿਆਦਾ ਖਰਚ ਨਹੀਂ ਹੁੰਦੀ ਗੀ ਸੋਲਰ ਸਿਸਟਮ ਵਧੀਆ ਹੁੰਦਾ ਵਾ ਬਿਜਲੀ ਕਰਕੇ ਜਿਵੇਂ ਸਰਦੀਆਂ ਵਿੱਚ ਬਿਜਲੀ ਨਾ ਹੋਣ ਕਰਕੇ ਅਸੀਂ ਪਾਣੀ ਗਰਮ ਨਹੀਂ ਕਰ ਪਾਉਂਦੇ ਗੀਜਰ ਵਗੈਰਾ ਤੇ ਯਾ ਕੁਛ ਵੀ ਨਾ ਬਿਜਲੀ 'ਤੇ ਅੱਜ ਕੱਲ੍ਹ ਸਾਰਾ ਕੁਝ ਬਿਜਲੀ 'ਤੇ ਨਿਰਭਰ ਆ ਜਿਵੇਂ ਸਾਡਾ ਖਾਣਾ ਪੀਣਾ ਹੋ ਗਿਆ ਫੋਨ ਚਾਰਜ ਲਾਉਣ ਪਾਣੀ ਗਰਮ ਕਰਨਾ ਸਾਰੀ ਸਾਰੀਆਂ ਚੀਜ਼ਾਂ ਟੋਟਲੀ ਬਿਜਲੀ 'ਤੇ ਹੀ ਹਨ